ਹੈਲੋ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹਾਂਜੀ ਤੁਸੀਂ ਕੌਣ ਓਕੇ ਹਾਂਜੀ

ਸੱਤ ਦਿਨ ਦੀ ਲੀਵ ਨਹੀਂ ਮੈਮ ਸੱਤ ਦਿਨ ਦੀ ਲੀਵ ਤਾਂ ਨਹੀਂ ਮਿਲ ਸਕਦੀ ਤੁਹਾਨੂੰ ਵੀ ਪਤਾ ਵਾ ਸੁਖ ਦੇ ਇਗਜ਼ਾਮ ਆਉਣ ਵਾਲੇ ਆ ਅਤੇ ਇਗਜ਼ਾਮ ਤੁਹਾਨੂੰ ਵੀ ਪਤਾ ਕਿੰਨੇ ਇੰਮਪੋਰਟੈਂਟ ਹੁੰਦੇ ਨੇ ਇਹ ਫਾਈਨਲ ਇਗਜ਼ਾਮ ਨੇ ਅਤੇ ਛੁੱਟੀ ਪੋਸੀਬਲ ਨਹੀਂ ਹੈ ਦੇਣੀ ਮੈਮ ਨਹੀਂ ਤੁਹਾਨੂੰ ਵੀ ਪਤਾ ਵਾ ਇਗਜ਼ਾਮ ਇਪੋਰਟੈਂਟ ਹੁੰਦੇ ਨੇ ਵੱਧ ਤੋਂ ਵੱਧ ਮੈਂ ਦੋ ਦਿਨ ਦੀ ਛੁੱਟੀ ਦੇ ਸਕਦੀ ਹਾਂ ਬਟ ਤਿੰਨ ਦਿਨ ਦੀ ਨਹੀਂ ਦੇ ਸਕਦੀ ਨਹੀਂ ਮੈਮ ਸਿਰਫ ਦੋ ਦਿਨ ਦੀ ਛੁੱਟੀ ਦੇ ਸਕਦੀ ਹਾਂ ਓਕੇ ਓਕੇ ਥੈਂਕ ਯੂ